ਸਰਕਾਰ ਸਾਡੀ ਆਪ ਆਮ ਆਦਮੀ ਪਾਰਟੀ ਸਰਕਾਰ ਹੈ ਸਾਡੀ ਬਹੁਤ ਵਧੀਆ ਕੰਮ ਕਰ ਰਹੀ ਹੈ ਬੁੜਾਪਾ ਪੈਨਸ਼ਨ ਹੋ ਗਏ ਕੋਈ ਠੀਕ ਹੈ ਜੀ ਅਤੇ ਕਈਆਂ ਨੂੰ ਨੌਕਰੀਆਂ ਬਹੁਤ ਵਧੀਆ ਨੌਕਰੀਆਂ ਲਗਵਾ ਰਹੇ ਨੇ ਕੰਮ ਕਰਵਾ ਰਹੇ ਨੇ ਅਤੇ ਜਿੱਦਾਂ ਟੁੱਟੀਆਂ ਸੜਕਾਂ ਸੁੜਕਾਂ ਉਹਨਾਂ ਨੂੰ ਸਹੀ ਬਹੁਤ ਵਧੀਆ ਕਰਵਾਈਆਂ ਨੇ ਉਹਨਾਂ ਨੇ ਸਰਕਾਰ ਸਾਡੀ ਨੇ ਅਤੇ ਜਿੱਦਾਂ ਕੋਈ ਫੌਜ 'ਚ ਜਿੱਦਾਂ ਸ਼ਹੀਦ ਹੋਏ ਉਹਨਾਂ ਨੂੰ ਕੋਈ ਪੈਂਸ਼ਨਾ ਉਹਨਾਂ ਦੇ ਘਰ ਦਿਆਂ ਨੂੰ ਕੋਈ ਜਿੱਦਾਂ ਕੋਈ ਖਰਚਾ ਵਾ ਜਿੱਦਾਂ ਕੋਈ ਪੈਸੇ ਦੇ ਦਿੰਦੇ ਨੇ ਉਹਨਾਂ ਦੇ ਪੈਨਸ਼ਨਾਂ ਉਹਨਾਂ ਦੇ ਮਾਤਾ ਪਿਤਾ ਨੂੰ ਪੈਨਸ਼ਨਾਂ ਲਾਉਂਦੇ ਨੇ ਕਾਫ਼ੀ ਬਹੁਤ ਸਹੂਲਤਾਂ ਦੇ ਰਹੇ ਨੇ ਬਿਜਲੀ ਫਰੀ ਹੈ ਜੀ ਕਾਫ਼ੀ ਸਹੂਲਤਾਂ ਦਿੱਤੀਆਂ ਹੋਈਆਂ ਬੁਢਾਪਾ ਨੂੰ ਬੁਢਾਪਾ ਪੈਨਸ਼ਨਾਂ ਨੂੰ ਬੁਢਾਪਾ ਨੂੰ ਕਾਫ਼ੀ ਜਾਨੀ ਕਿ ਵਿਧਵਾ ਔਰਤਾਂ ਨੂੰ ਵੀ ਪੈਨਸ਼ਨ ਲਾਈਆਂ ਨੇ ਕਾਫ਼ੀ ਉੱਥੇ ਵਧੀਆ ਕੰਮ ਕਰਦੀ ਆ ਸਾਡੀ ਸਰਕਾਰ ਬਹੁਤ ਵੱਧ ਤੋਂ ਵੱਧ ਵਧੀਆ ਕੰਮ ਕਰ ਰਹੀ ਹੈ ਕਿਸੇ ਇੱਕ ਚੀਜ਼ ਦੀ ਸਾਨੂੰ ਕਿਸੇ ਚੀਜ਼ ਦੀ ਉਹ ਨੀ ਕੀਤੀ ਹੋਈ